ਕੀ ਮੈਂ ਜੀ ਪੇਅ ਦੇ ਓਫਿਸ ਦੇ ਵਿੱਚ ਗੱਲ ਕਰ ਰਿਹਾ ਹਾਂ ਮੈਂ ਆਪਣੇ ਫ਼ੋਨ ਨੰਬਰ ਤਰਿਆਨਮੇ ਬੱਤੀ ਤੇਤਾ ਤੇਰਾਂ ਪੈਂਤੀ ਦੇ ਰੀਚਾਰਜ ਲਈ ਆਪ ਜੀ ਦੀ ਐਪ ਦੁਆਰਾ ਪੰਜ ਸੌ ਰੁਪਿਆ ਭੇਜਿਆ ਹੈ ਮੇਰਾ ਜੀ ਪੇਅ ਆਈ ਡੀ ਨੰਬਰ ਤਿੰਨ ਸੱਤ ਅੱਠ ਨੌਂ ਹੈ ਤੇ ਕੀ ਮੈਂ ਇਸਦੇ ਸਬੰਧੀ ਆਪਣੇ ਸਟੇਟਸ ਦਾ ਪਤਾ ਕਰ ਸਕਦਾ ਹਾਂ ਕਿਰਪਾ ਕਰਕੇ ਇਹ ਸਾਰੀ ਲੈਣ ਦੇਣ ਦੀ ਜੋ ਵੀ ਇਸ ਵਕਤ ਦੀ ਸਥਿਤੀ ਹੈ ਕਿਰਪਾ ਕਰਕੇ ਮੈਨੂੰ ਦੱਸੀ ਜਾ ਸਕਦੀ ਹੈ ਥੈਂਕਿਊ ਆਪ ਜੀ ਦਾ ਧੰਨਵਾਦ ਕਰੂੰਗਾ ਕਿਉਂਕਿ ਮੈਨੂੰ ਵਾਰ ਵਾਰ ਓਥੋਂ ਮੈਸਿਜ ਆਉਂਦੇ ਰਹਿੰਦੇ ਨੇ ਮੈਂ ਚੈੱਕ ਕਰਨਾ ਚਾਹੁੰਦਾ ਸੀ ਕਿ ਮੈਂ ਪੇਮੈਂਟ ਤਾਂ ਕਰ ਦਿੱਤੀ ਹੈ ਕੀ ਪੇਮੈਂਟ ਹੋ ਗਈ ਹੈ ਜਾਂ ਹਜੇ ਵੀ ਕੁਛ ਮੇਰਾ ਬਕਾਇਆ ਬਾਕੀ ਹੈ ਜੇ ਹੋ ਗਈ ਤਾਂ ਮੈਨੂੰ ਜਲਦੀ ਤੋਂ ਜਲਦੀ ਇਸ ਬਾਰੇ ਦੱਸਿਆ ਜਾਵੇ